ਹੈਲੋ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ ਸੂਟ ਸਿਲਾਉਣਾ ਉਹਦੇ ਲਈ ਮੇਜਰਮੈਂਟ ਮੇਰਾ ਲੈ ਲਓ ਲੰਬਾਈ ਫੋਰਟੀ ਟੂ ਕਮਰ ਮੇਰੀ ਥਰਟੀ ਸਿਕਸ ਚੈਸਟ ਫੋਰਟੀ ਬਾਜੂ ਮੇਰੀ ਵੀਹ ਰੱਖ ਦਿਉ ਘੇਰਾ ਇੱਕੀ ਫਲੇਅਰ ਵਾਲਾ ਲੰਬਾਈ ਥਰਟੀ ਸੈਵਨ

ਸਰ ਪ੍ਰਾਈਜ਼ ਤਾਂ ਇਹਦਾ ਕੀ ਰਹੇਗਾ ਅੱਛਾ ਠੀਕ ਹੈ ਜੀ ਠੀਕ ਹੈ ਜੀ